ਜਿਵੇਂ ਕਿ ਆਪਾਂ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਸ਼੍ਰੀ ਦਰਬਾਰ ਸਾਹਿਬ ਜੋ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਵਸਾਇਆ ਹੋਇਆ ਸ਼ਹਿਰ ਹੈ ਨਾਲ ਦੇ ਨਾਲ ਹੀ ਉਹ ਗੁਰਦੁਆਰਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਬਣਾਇਆ ਹੋਇਆ ਹੈ ਸਾਡਾ ਤਰਨਤਾਰਨ ਸ਼ਹਿਰ ਹੀ ਇਸੇ ਕਰਕੇ ਹੀ ਬਹੁਤ ਜ਼ਿਆਦਾ ਫੇਮਸ ਹੈ ਇੱਥੇ ਜਦੋਂ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਨ ਤਾਂ ਉਹਦੇ ਨਾਲ ਹੋਰ ਵੀ ਬਿਜ਼ਨਸਿਸ ਨੂੰ ਜਾਂ ਜਿਹੜੇ ਲਾਗੇ ਵਾਲੇ ਵਪਾਰ ਹਨ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਹੁੰਦਾ ਹੈ ਜਿਵੇਂ ਕਿ ਸੰਗਤਾਂ ਆਉਂਦੀਆਂ ਹਨ ਜਾਂ ਹੋਰ ਵੀ ਟੂਰਿਸਟ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਨ ਤਾਂ ਉਹ ਲੋਕਲ ਚੀਜ਼ਾਂ ਨੂੰ ਟਰਾਏ ਕਰਦੇ ਹਨ ਭਾਵੇਂ ਉਹ ਖਾਣ ਪੀਣ ਨੂੰ ਲੈ ਕੇ ਹੈ ਭਾਵੇਂ ਉਹ ਪਹਿਰਾਵੇ ਨੂੰ ਕਰਕੇ ਹੈ ਹੁਣ ਜਦੋਂ ਦੇਖਿਆ ਜਾਵੇ ਤਾਂ ਉੱਥੇ ਕਿੰਨੇ ਜ਼ਿਆਦੀਆਂ ਪਹਿਰਾਵੇ ਵਾਲੀਆਂ ਦੁਕਾਨਾਂ ਹਨ ਜਿਵੇਂ ਕਿ ਟੀਸ਼ਟਾਂ ਦੇ ਉੱਪਰ ਸਿੱਖਇਜ਼ਮ ਦੇ ਰਿਲੇਟਿਡ ਕੁਛ ਲਿਖਿਆ ਹੁੰਦਾ ਹੈ ਤਾਂ ਫੋਰਨ ਦੇ ਟੂਰਿਸਟ ਜਾਂ ਹੋਰ ਜਿਹੜੇ ਇੰਡੀਆ ਤੋਂ ਟੂਰਿਸਟ ਪੂਰੇ ਭਾਰਤ ਤੋਂ ਆਉਂਦੇ ਹਨ ਉਹ ਉਹਨਾਂ ਚੀਜ਼ਾਂ ਨੂੰ ਕੇ ਬੜਾ ਪ੍ਰਸੰਨ ਹੁੰਦੇ ਹਨ ਅਟਰੈਕਟ ਹੁੰਦੇ ਹਨ ਅਤੇ ਉਹ ਚੀਜ਼ਾਂ ਨੂੰ ਖਰੀਦਦੇ ਹਨ ਵੱਖਰੇ ਵੱਖਰੇ ਖਾਣਿਆਂ ਨੂੰ ਉਹ ਖਾਣਾ ਪਸੰਦ ਕਰਦੇ ਹਨ ਜਿਹਦੇ ਨਾਲ ਕਿ ਪੂਰੇ ਤਰਨਤਾਰਨ ਸ਼ਹਿਰ ਦੀ ਆਰਥਿਕ ਵਿਵਸਥਾ ਵਧੀਆ ਹੁੰਦੀ ਹੈ ਅਤੇ ਪੂਰਾ ਸ਼ਹਿਰ ਹੌਲੀ ਹੌਲੀ ਕਰਕੇ ਡੈਵਲਪ ਹੋ ਰਿਹਾ ਹੈ